ਸਤਿ ਸ਼੍ਰੀ ਅਕਾਲ ਜੀ ਮੈਂ ਪਿਛਲੇ ਦਿਨ ਹੀ ਤੁਹਾਡੇ ਤੋਂ ਕੁੜਤੀ ਔਡਰ ਕੀਤੀ ਸੀ ਜੋ ਕਿ ਜੋ ਕਿ ਮੈਂ ਦੇਖ ਜ ਜੋ ਕਿ ਮੈਂ ਖੋਲ੍ਹਣ 'ਤੇ ਦੇਖੀ ਜਿਸਦੀ ਪੈਕੇਜਿੰਗ ਸਹੀ ਨਹੀਂ ਸੀ ਪੈਕੇਜਿੰਗ ਫਟੀ ਹੋਈ ਸੀ ਅਤੇ ਇਸ ਵਿੱਚ ਜੋ ਅਤੇ ਇਸ 'ਤੇ ਜੋ ਪ੍ਰਿੰਟ ਸੀਗਾ ਉਹ ਬਿਲਕੁਲ ਉੱਦਾਂ ਦਾ ਨਹੀਂ ਸੀ ਬਿਲਕੁਲ ਹੀ ਅਲੱਗ ਸੀਗਾ ਅਤੇ ਇਸਦਾ ਕਲਰ ਵੀ ਬਹੁਤ ਪੁਰਾਣਾ ਪੁਰਾਣਾ ਅਤੇ ਭੱਦਾ ਜਿਹਾ ਲੱਗ ਰਿਹਾ ਸੀ ਅਤੇ ਇਸਦਾ ਸਾਈਜ਼ ਵੀ ਸਹੀ ਨਹੀਂ ਸੀਗਾ ਜੋ ਕਿ ਮੇਰੇ ਨਹੀਂ ਆਇਆ ਅਤੇ ਇਸਦਾ ਕੱਪੜਾ ਵੀ ਬਹੁਤ ਪੁਰਾਣਾ ਜਿਹਾ ਸੀਗਾ ਇਸਦੀ ਸਟੀਚਿੰਗ ਵੀ ਬਹੁਤ ਗੰਦੀ ਕੀਤੀ ਹੋਈ ਸੀ ਜੋ ਕਿ ਜਿਸਦੀਆਂ ਕਿ ਸੀਊਣਾ ਦਿੜ੍ਹ ਦਿੜ੍ਹ ਰਹੀਆਂ ਸਨ ਇਹ ਮੈਨੂੰ ਮਾਰਕੀਟ ਨਾਲੋਂ ਵੀ ਮਹਿੰਗਾ ਹੀ ਪੈ ਗਿਆ ਹੈ ਅਤੇ ਮੈਂ ਇਸ ਲਈ ਆਪਣੇ ਭੈਣਾਂ ਨੂੰ ਵੀ ਰੈਕਮੈਂਡ ਕੀਤਾ ਸੀ ਕਿ ਔਡਰ ਕਰ ਦਿਉ ਬਟ ਮੈਂ ਉਹਨਾਂ ਦੇ ਵੀ ਔਡਰ ਕੈਂਸਲ ਕਰਵਾ ਦਿੱਤੇ ਹਨ ਕਿਉਂਕਿ ਇਹ ਸ ਇਹ ਸਹੀ ਨਹੀਂ ਆਇਆ ਔਰ ਅਤੇ ਇਸਦੀ ਪੈਕੇਜਿੰਗ ਸਭ ਕੁਛ ਕੁਛ ਵੀ ਸਹੀ ਨਹੀਂ ਗਾ ਨਹੀਂ ਸੀ ਇਸ ਕਰਕੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਮੇਰੀ ਪੇਮੈਂਟ ਵਾਪਸ ਕਰ ਦਿੱਤੀ ਜਾਵੇ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ